ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਵਿੰਦਰ ਬਿੰਦੂ ਹੈ ਮੈਂ ਜੀ ਤੁਹਾਤੋਂ ਛੇ ਮਹੀਨੇ ਪਹਿਲਾਂ ਵੋਸ਼ਿੰਗ ਮਸ਼ੀਨ ਮੰਗਾਈ ਸੀ ਜੋ ਜੋ ਆਪ ਜੀ ਨੇ ਹਾ ਗਾਈਡਲਾਈਨਜ਼ ਦਿੱਤੀਆਂ ਹੈ ਉਹਦੇ ਅਨੁਸਾਰ ਹੀ ਮਸ਼ੀਨ ਬਹੁਤ ਵਧੀਆ ਤਰੀਕੇ ਨਾਲ ਚਲ ਰਹੀ ਹੈ ਆਪ ਜੀ ਦਾ ਇੱਕ ਬੰਦਾ ਆ ਕੇ ਸਾਨੂੰ ਸਮਝਾ ਗਿਆ ਸੀ ਕੀ ਇਵੇਂ ਇਵੇਂ ਆ ਮਸ਼ੀਨ ਚਲਾਣੀ ਹੈ ਅਸੀਂ ਉਦਾਂ ਹੀ ਚਲਾ ਰਹੇ ਹਾਂ ਕੀ ਬਹੁਤ ਹੀ ਵਧੀਆ ਹੈ ਕੱਪੜੇ ਫਟਾਫਟ ਜਿਹੜੇ ਪਹਿਲਾ ਪੂਰਾ ਦਿਨ ਲੱਗਦਾ ਸੀ ਹੁਣ ਫਟਾਫਟ ਧੋ ਵੀ ਦਿੰਦੀ ਸੁਕਾ ਵੀ ਦਿੰਦੀ ਹੈਗੀ ਹੈ ਅਤੇ ਸਾਡੇ ਆਂਢੀ ਗੁਆਂਢੀ ਵੀ ਆ ਕੇ ਪੁੱਛਦੇ ਹੈ ਕਿ ਤੁਸੀਂ ਇਹ ਮਸ਼ੀਨ ਕਿੱਥੋਂ ਲਈ ਹੈ ਅਤੇ ਮੈਂ ਕਹਿੰਦੇ ਕੀ ਅਸੀਂ ਵੀ ਮੰਗਾਉਣੀ ਹੈ ਫਿਰ ਮੈਂ ਤੁਹਾਡਾ ਵੀ ਐਡਰੈੱਸ ਦਿੱਤਾ ਮੈਂ ਕਿਹਾ ਵੀ ਉੱਥੋਂ ਮੰਗਵਾ ਲਓ ਕਹਿੰਦੇ ਕੀ ਐਨੀ ਮਹਿੰਗੀ ਮਸ਼ੀਨ ਤੁਹਾਨੂੰ ਘੱਟ ਰੇਟਾਂ 'ਤੇ ਕਿਵੇਂ ਮਿਲ ਗਈ ਮੈਂ ਕਿਹਾ ਵੀ ਸਾਨੂੰ ਤਾਂ ਇਸ ਇਹਨਾਂ ਨੇ ਸਾਨੂੰ ਭੇਜੀ ਹੈ ਤੁਸੀਂ ਐਡਰੈੱਸ ਲੈ ਲਓ ਅਤੇ ਉਨ੍ਹਾਂ ਨੇ ਹੁਣ ਤੁਹਾਨੂੰ ਵੀ ਉਹ ਕਰਨਗੇ ਕੋਲ ਦੋ ਤਿੰਨ ਗੁਆਂਢੀ ਹੈ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਵੋਸ਼ਿੰਗ ਮਸ਼ੀਨ ਦੀ ਅਤੇ ਆਪਦੀ ਵੋਸ਼ਿੰਗ ਮਸ਼ੀਨ ਜੋ ਭੇਜੀ ਹੋਈ ਹੈ ਉਸਦਾ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਬਹੁਤ ਹੀ ਧੰਨਵਾਦ ਕਰਦੇ ਹਾਂ